ਜੇ ਮੈਂ ਕੋਈ ਨਵੀਂ ਚਿੱਤਰਕਾਰੀ ਕਰਦੀ ਹਾਂ ਤਾਂ ਪਹਿਲਾਂ ਮੈਂ ਆਪਣੇ ਮਨ ਵਿੱਚ ਸੋਚਦੀ ਹਾਂ ਜਿਵੇਂ ਮੰਨ ਲਓ ਮੈਂ ਮੇਰੇ ਮਨ ਵਿੱਚ ਵਿਚਾਰ ਆਉਂਦੇ ਹਨ ਕਿ ਜਿਵੇਂ ਅੱਜ ਕੱਲ੍ਹ ਰੁੱਖਾਂ ਨੂੰ ਕਿੰਨਾ ਜ਼ਿਆਦਾ ਕੱਟਿਆ ਜਾ ਰਿਹਾ ਤਾਂ ਮੈਨੂੰ ਇਸ ਦੇ ਬਾਰੇ ਬਹੁਤ ਦੁੱਖ ਹੁੰਦਾ ਤਾਂ ਮੈਂ ਜਿਵੇਂ ਇੱਕ ਪਿੱਛੇ ਬਣਾਈ ਇੱਕ ਰੁੱਖ ਦੀ ਪੇਂਟਿੰਗ ਬਣਾਈ ਜਿਸ ਵਿੱਚ ਉਸ ਨੂੰ ਕੱਟਿਆ ਜਾ ਰਿਹਾ ਸੀ ਅਤੇ ਰੁੱਖ ਜਿਹੜਾ ਹੰਝੂ ਵਹਾਅ ਰਿਹਾ ਸੀ ਇੰਨੇ ਫਾਇਦੇ ਸਾਨੂੰ ਰੁੱਖ ਦੇ ਹੁੰਦੇ ਹਨ ਇੰਨਾ ਕੁਛ ਰੁੱਖ ਸਾਨੂੰ ਦਿਖ ਦਿੰਦੇ ਹਨ ਤਾਂ ਵੀ ਅਸੀਂ ਮਨੁੱਖ ਕਿੰਨੇ ਲਾਲਚਵੱਸ ਹੋ ਕੇ ਉਨ੍ਹਾਂ ਨੂੰ ਕੱਟ ਦਿੰਦੇ ਹਾਂ ਅਤੇ ਅਸੀਂ ਆਪਣੇ ਵਾਤਾਵਰਣ ਨੂੰ ਆਪ ਹੀ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਇਸ ਦੇ ਬਾਰੇ ਜੇ ਮੈਂ ਕੋਈ ਪੇਂਟਿੰਗ ਵਗੈਰਾ ਬਣਾਉਣੀ ਹੋਵੇ ਤਾਂ ਮੈਂ ਗੂਗਲ ਤੋਂ ਵੀ ਹੈਲਪ ਲੈਂਦੀ ਹਾਂ ਅਤੇ ਮੈਂ ਆਪਣੀ ਕਲਪਨਾ ਦੇ ਨਾਲ ਵੀ ਉਸ ਦ੍ਰਿਸ਼ ਨੂੰ ਪੇਸ਼ ਕਰ ਦਿੰਦੀ ਹਾਂ